ਮੈਨੂੰ ਘੁੰਮਣ ਦਾ ਬਹੁਤ ਸ਼ੌਕ ਹੈ ਇੱਕ ਵਾਰ ਦੀ ਵਾਰੀ ਅਸੀਂ ਸਾਰੇ ਦੋਸਤ ਘੁੰਮਣ ਦਾ ਪਲੈਨ ਬਣਾਇਆ ਅਤੇ ਅਸੀਂ ਘੁੰਮਣ ਗਏ ਸ਼ਿਮਲੇ ਅਤੇ ਉੱਥੇ ਅਸੀਂ ਬਹੁਤ ਜਗ੍ਹਾ 'ਤੇ ਘੁੰਮੇ ਅਸੀਂ ਪਹਾੜਾਂ ਦੇ ਉੱਪਰ ਚੜ੍ਹੇ ਅਤੇ ਪਹਾੜ ਬਹੁਤ ਉੱਪਰ ਤਿੱਖਾ ਸੀਗਾ ਅਤੇ ਅਸੀਂ ਸਾਰਿਆਂ ਦੋਸਤਾਂ ਨੇ ਪਲੈਨ ਬਣਾਇਆ ਕਿ ਅਸੀਂ ਸਾਰਿਆਂ ਨੇ ਜਾਣਾ ਹੈ ਉੱਪਰ ਅਤੇ ਫਿਰ ਅਸੀਂ ਪਹਾੜ ਚੜਨ ਲੱਗੇ ਫਿਰ ਮੇਰੇ ਦੋਸਤ ਦਾ ਪੈਰ ਸਲਿੱਪ ਹੋ ਗਿਆ ਫਿਰ ਉਹਨੂੰ ਮੈਂ ਫੜ ਕੇ ਰੋਕਿਆ ਫਿਰ ਫਿਰ ਅਸੀਂ ਸਾਰੇ ਇਕੱਠੇ ਇੱਕ ਪੇੜ ਦਾ ਸਹਾਰਾ ਲੈ ਕੇ ਚੜੇ ਉੱਪਰ ਅਸੀਂ ਸਾਰੇ ਥੱਕ ਵੀ ਗਏ ਸੀਗੇ ਉੱਪਰ ਚੜ੍ਹਦੇ ਚੜ੍ਹਦੇ ਅਤੇ ਮੇਰਾ ਦੋਸਤ ਵੀ ਥੱਕ ਗਿਆ ਸੀ ਅਸੀਂ ਸਾਰਿਆਂ ਨੇ ਫਿਰ ਪਾਣੀ ਪੀਤਾ ਫਿਰ ਅਸੀਂ ਫਿਰ ਚੜ੍ਹਨ ਲੱਗੇ ਅਸੀਂ ਸਾਰਿਆਂ ਨੇ ਸੋਚ ਲਿਆ ਤਾਂ ਅਸੀਂ ਸਿਖਰ 'ਤੇ ਜਾਣਾ ਹੀ ਜਾਣਾ ਹੈ ਅਤੇ ਜ ਅਸੀਂ ਜਦੋਂ ਅਸੀਂ ਉੱਪਰ ਪਹੁੰਚ ਗਏ ਉੱਥੇ ਅਸੀਂ ਜਦੋਂ ਨਜ਼ਾਰਾ ਦੇਖਿਆ ਉੱਥੇ ਬਹੁਤ ਹੀ ਘੈਂਟ ਨਜ਼ਾਰਾ ਸੀਗਾ ਜਿਹੜਾ ਸਾਨੂੰ ਦਿਲ ਨੂੰ ਛੂ ਗਿਆ ਉਹ ਨਜ਼ਾਰਾ ਸਾਨੂੰ ਅੱਜ ਤੱਕ ਯਾਦ ਹੈ ਅਤੇ ਬਹੁਤ ਖੂਬਸੂਰਤ ਨਜ਼ਾਰਾ ਸੀਗਾ ਉੱਥੇ ਕਈ ਤਰ੍ਹਾਂ ਦੇ ਝੂਲੇ ਵੀ ਲੱਗੇ ਹੋਏ ਤੇ ਉੱਪਰ ਲ ਸ ਸਾਈਡ ਉੱਤੇ ਉੱਥੇ ਕਈ ਲੋਕ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਬਹੁਤ ਟੂਰਿਸਟ ਵੀ ਘੁੰਮਦੇ ਰਹਿੰਦੇ ਹਨ ਉੱਥੇ